ਯੋਗਾ ਇਕ ਬਹੁਤ ਬੜੀਆ ਚੀਜ਼ ਹੈ ਇਸ ਦੇ ਨਾਲ ਸਰੀਰ ਮਾਨਸਿਕ ਅਤੇ ਸਰੀਰ ਦੋਨੋਂ ਰੂਪ ਤੋਂ ਸੁਰੱਖਿਅਤ ਅਤੇ ਵਧੀਆ ਰਹਿੰਦਾ ਹੈ ਯੋਗਾ ਇਕ ਬਹੁਤ ਹੀ ਪ੍ਰਾ ਪ੍ਰਾਚਾਨਕ ਜੋ ਕੀ ਬਹੁਤ ਪ੍ਰਾਚੀਨ ਹੈ ਬਹੁਤ ਸਮੇਂ ਤੋਂ ਚਲਦੀ ਆ ਰਹੀ ਹੈ ਜਿਸ ਸਮੇਂ ਵਿੱਚ ਦਵਾਈਆਂ ਦਾ ਉਹਨਾਂ ਨਹੀਂ ਸੀ ਆਯੂਰਵੇਦਿਕ ਸਮੇਂ ਦਾ ਉਸ ਸਮੇਂ ਤੋਂ ਹੀ ਯੋਗਾ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ ਸਰੀਰ ਵਿੱਚ ਕੋਈ ਵੀ ਬਿਮਾਰੀ ਹੋਏ ਕਿਸੇ ਵੀ ਤਰ੍ਹਾਂ ਦਾ ਰੋਗ ਹੋਏ ਤਾਂ ਯੋਗਾ ਉਸ ਦਾ ਹੱਲ ਹੈ ਯੋਗਾ ਬਹੁਤ ਵੱਖਰੇ ਵੱਖਰੇ ਪ੍ਰਕਾਰ 'ਚ ਆਉਂਦਾ ਹੈ ਅਤੇ ਯੋਗਾ ਬਿਨਾਂ ਸਿਖੇ ਕਰਨਾ ਸਰੀਰ ਲਈ ਬਹੁਤ ਮਾੜਾ ਹੋ ਸਕਦਾ ਹਾਨੀਕਾਰਕ ਹੋ ਸਕਦਾ ਕਿਉਂਕਿ ਯੋਗਾ ਦੇ ਆਪਣੇ ਆਪਣੇ ਪੁਜੀਸ਼ਨ ਹੁੰਦੀ ਹਨ ਆਪਣੇ ਕਰਨ ਦੇ ਤਰੀਕੇ ਹੁੰਦੇ ਹਨ ਅਤੇ ਅਗਰ ਉਹਨਾਂ ਨੂੰ ਅਸੀਂ ਨਹੀਂ ਫੋਲੋ ਕਰਦੇ ਤਾਂ ਉਹ ਸਾਡੇ ਲਈ ਨੁਕਸਾਨਦੇਹ ਹੋ ਸਕਦਾ ਅਗਰ ਯੋਗਾ ਸਿੱਖਣ ਦੀ ਗੱਲ ਕਹੀਏ ਤਾਂ ਸਵੇਰੇ ਸਵੇਰੇ ਬਾਬਾ ਰਾਮਦੇਵ ਜੀ ਵੱਖਰੇ ਵੱਖਰੇ ਨਿਊ ਚੈਨਲ ਜਿਵੇਂ ਕਿ ਇੰਡੀਆ ਟੀ ਵੀ 'ਤੇ ਆਉਂਦੇ ਹਨ ਅਤੇ ਉਹਦੇ ਨਾਲ ਨਾਲ ਆਸਥਾ ਚੈਨਲ 'ਤੇ ਆਉਂਦੇ ਆ ਉਹਨਾਂ ਵੱਲੋਂ ਭਾਰਤ ਵਿੱਚ ਯੋਗਾ ਦੀ ਫੀਲਡ ਦਾ ਬਹੁਤ ਮਾਹਿਰ ਬੰਦਾ ਮੰਨਿਆ ਜਾਂਦਾ ਹੈ ਤਾਂ ਮੈਂ ਹਮੇਸ਼ਾ ਉਹਨਾਂ ਨੂੰ ਦੇਖ ਕੇ ਹੀ ਥੋੜ੍ਹੇ ਬਹੁਤ ਯੋਗਾ ਦੇ ਆਸਣ ਸਿੱਖਦਾ ਹਾਂ ਇਹਨਾਂ ਵਿੱਚੋਂ ਇੱਕ ਦੋ ਤਾਂ ਸਵਾਸ ਆਸਨ ਹੈ ਜਿਹਦੇ ਵਿੱਚ ਅਸੀਂ ਇੱਕ ਨੱਕ ਤੋਂ ਨੱਕ ਦੇ ਇੱਕ ਪਾਸੋਂ ਸਾਹ ਅੰਦਰ ਅਤੇ ਦੂਜੇ ਪਾਸੋਂ ਬਾਹਰ ਖਿੱਚਦੇ ਹਾਂ ਜਿਸ ਨਾਲ ਸਾਡੀ ਚੈਸਟ

ਡਾਇਬਟੀਜ਼ ਇਨਾ ਇਹੋ ਜਿਹੀਆਂ ਬਿਮਾਰੀਆਂ ਦਾ ਵੀ ਇਲਾਜ ਹੋ ਸਕਦਾ ਹੈ ਪਰ ਅਗਰ ਬੰਦਾ ਯੋਗਾ ਬਿਨਾਂ ਸਿੱਖੇ ਕਰਦਾ ਹੈ ਤਾਂ ਉਸ ਦੇ ਲਈ ਹਾਨੀਕਾਰਕ ਵੀ ਉਨਾ ਹੀ ਹੋ ਸਕਦਾ ਹੈ ਜਦੋਂ ਯੋਗਾ ਸਿੱਖਣ ਜਾਂ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਸ ਸਮੇਂ ਬੰਦੇ ਨੂੰ ਇਹ ਮੁਸ਼ਕਿਲ ਆਉਂਦੀ ਹੈ ਕਿ ਬੰਦਾ ਕਿਸ ਤੋਂ ਸਿੱਖੇ ਕਿਸ ਪੁਜੀਸ਼ਨ 'ਚ ਯੋਗਾ ਕਰੇ ਕਿੱਥੇ ਬਹਿ ਕੇ ਕਰੇ ਅਤੇ ਉਸ ਦੇ ਲਈ ਵੱਖਰੇ ਵੱਖਰੇ ਸਾਧਨ ਜਿੱਦਾਂ ਮੈਟ ਵਗੈਰਾ ਉਹਨਾਂ ਦਾ ਬੰਦਾ ਬਹੁਤ ਸੋਚਦਾ ਹੈ ਅਤੇ ਬੰਦਾ ਇਹ ਸੋਚਦਾ ਹੈ ਕਿ ਇਸ ਨੂੰ ਕੋਈ ਚੀਜ਼ ਹੈ ਬਿਮਾਰੀ ਹੈ ਐਲਰਜੀ ਹੈ ਤਾਂ ਉਹ ਯੋਗਾ ਕਰ ਸਕਦਾ ਕਿ ਨਹੀਂ ਕਰ ਸਕਦਾ ਅਤੇ ਇਸ ਦੀ ਜਾਣਕਾਰੀ ਘੱਟ ਹੋਣ ਕਰਕੇ ਉਹ ਹਮੇਸ਼ਾ ਦੁਵੰਧ 'ਚ ਹੀ ਰਹਿ ਜਾਂਦਾ ਹੈ